ਮੇਰਾ ਨਾਮ ਨੈਨਸੀ ਹੈ ਮੈਂ ਤੁਹਾਨੂੰ ਪੁਰਾਣੇ ਸਮੇਂ ਦੀਆਂ ਕੁਝ ਸੱਭਿਆਚਾਰਕ ਨੂੰ ਬਚਾਉਣ ਅਤੇ ਉਤਸ਼ਾਹਿਤ ਕਰਨ ਬਾਰੇ ਕੁਝ ਦੱਸਣਾ ਚਾਹੁੰਦੀ ਹਾਂ ਕਿ ਪੁਰਾਣੇ ਸਮੇਂ ਵਿੱਚ ਖੇਡਾਂ ਕਿਹੜੀਆਂ ਕਿਹੜੀਆਂ ਹੁੰਦੀਆਂ ਸੀ ਪੁਰਾਣੇ ਸਮੇਂ ਵਿੱਚ ਕਬੱਡੀ ਖੋ ਖੋ ਕੁਸ਼ਤੀ ਹੋਕੀ ਆਦਿ ਖੇਡਾਂ ਖੇਡੀਆਂ ਜਾਂਦੀਆਂ ਸੀ ਲੋਕ ਖੇਡਾਂ ਨੂੰ ਦੇਖਣ ਲਈ ਟੀ ਵੀ 'ਤੇ ਦੇਖਦੇ ਸਨ ਅਤੇ ਗਰਾਉਂਡ ਵਿੱਚ ਮੈਚ ਵੀ ਲਗਾਏ ਲਗਾਉਂਦੇ ਸਨ ਅਤੇ ਸਾਰੇ ਪਿੰਡ ਦੇ ਲੋਕ ਮੈਚ ਦੇਖਣ ਲਈ ਗਰਾਊਂਡ ਵਿੱਚ ਆਉਂਦੇ ਹਨ ਅਤੇ ਸੱਭਿਆਚਾਰਕ ਵਿੱਚ ਰਵਾਇਤੀ ਖੇਡਾਂ ਦੀ ਭੂਮਿਕਾ ਨਿਭਾਈ ਜਾਂਦੀ ਹੈ ਅਤੇ ਗਰਾਊਂਡ ਵਿੱਚ ਮੈਚ ਵੀ ਲਗਾਏ ਜਾਂਦੇ ਹਨ ਮੈਚ ਦੇ ਖੇਡਣ ਵਾਲੇ ਬਹੁਤ ਹੀ ਤਕੜੇ ਹੁੰਦੇ ਹਨ ਅਤੇ ਮੈਚ ਵੀ ਬਹੁਤ ਸ਼ਾਨਦਾਰ ਹੁੰਦਾ ਹੈ ਮੈਚ ਖੇਡਣ ਵਾਲੇ ਅਖਾੜੇ ਦੇ ਆਲੇ ਦੁਆਲੇ ਲੋਕ ਮੈਚ ਦੇਖਣ ਲਈ ਖੜ੍ਹ ਜਾਂਦੇ ਹਨ